ਸਾਡੇ ਰਾਜ ਵਿੱਚ ਪੰਜਾਬੀ ਸਿੱਖਿਆ ਦੀ ਭੂਮਿਕਾ ਜਿਵੇਂ ਕਿ ਅਸੀਂ ਜਾਣਦੇ ਹਾਂ ਸਾਡੀ ਸਿੱਖਿਆ ਪ੍ਰਣਾਲੀ ਹੈ ਜਿਹੜਾ ਸਾਡਾ ਪਹਿਲਾ ਐਕਟ ਆ ਉਹ ਕਹਿੰਦਾ ਵੀ ਜਿਹੜਾ ਸਭ ਤੋਂ ਪਹਿਲਾਂ ਬੱਚਾ ਉਹ ਸਿੱਖਦਾ ਆਪਣੀ ਮਾਤ ਭਾਸ਼ਾ ਸਿੱਖਦਾ ਆਪਣੀ ਪੰਜਾਬੀ ਬੋਲਣੀ ਸਿੱਖਦਾ ਬਟ ਸਾਡੇ ਪੰਜਾਬ ਬੋਰਡ ਦੇ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੀ ਬਹੁਤ ਮਹੱਤਤਾ ਹੈ ਪਹਿਲਾਂ ਬੱਚੇ ਨੂੰ ਮਾਂ ਬੋਲੀ ਨਾਲ ਹੀ ਜੋੜਿਆ ਜਾਂਦਾ ਪੰਜਾਬੀ ਹੀ ਬੋਲਣੀ ਸਿਖਾਈ ਜਾਂਦੀ ਹੈ ਪਰ ਸਾਡੇ ਪ੍ਰਾਈਵੇਟ ਸਕੂਲ ਆ ਜਿਹੜੇ ਉਹ ਇੰਗਲਿਸ਼ ਦੇ ਸ਼ੋਸ਼ਿਆਂ ਵਿੱਚ ਪੈ ਕੇ ਪੰਜਾਬੀ ਦੀ ਜਿਹੜੀ ਹੈਗੀ ਆ ਜਿਹੜੀ ਵਰਤੋਂ ਘੱਟ ਕਰਦੇ ਆ ਉਹ ਬੱਚੇ ਨੂੰ ਫਸਟ ਲੈਂਗੁਏਜ ਇੰਗਲਿਸ਼ ਦੱਸਦੇ ਆ ਬਟ ਉਹ ਗਲਤ ਗੱਲ ਹੈ ਵੀ ਪਹਿਲਾਂ ਆਪਣੀ ਜਿਹੜੀ ਮਾਤ ਭਾਸ਼ਾ ਬੱਚੇ ਜਿਹੜਾ ਸਭ ਤੋਂ ਵੱਧ ਸਿੱਖਦਾ ਉਹ ਆਪਣੀ ਮਾਤ ਭਾਸ਼ਾ ਵਿੱਚ ਹੀ ਸਿੱਖਦਾ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਪੰਜਾਬ ਵਿੱਚ ਰਹਿਣ ਵਿੱਚ ਰਹਿਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਪੰਜਾਬੀ ਹੀ ਸਿੱਖਣੀ ਚਾਹੀਦੀ ਹੈ ਜਿਵੇਂ ਅਸੀਂ ਜਾਣਦੇ ਹਾਂ ਵੀ ਪੰਜਾਬ ਵਿੱਚ ਪੰਜਾਬੀ ਦੀ ਬਹੁਤ ਮਹੱਤਤਾ ਕਿਉਂਕਿ ਪੰਜਾਬ ਵਿੱਚ ਨੌਕਰੀ ਲੈਣ ਲਈ ਸਾਨੂੰ ਪੰਜਾਬੀ ਪੜ੍ਹਨੀ ਬਹੁਤ ਜ਼ਰੂਰੀ ਹੈ ਜਿਹੜਾ ਬੱਚਾ ਪੰਜਾਬੀ ਪੜ੍ਹਿਆ ਹੁੰਦਾ ਹੈ ਉਹਨੂੰ ਹੀ ਪੰਜਾਬ ਦੇ ਜਿਹੜੇ ਸਾਰੇ ਪੇਪਰਾਂ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਂਦਾ ਅਤੇ ਪੰਜਾਬੀ ਦੀ ਭੂਮਿਕਾ ਸਭ ਤੋਂ ਮੇਨ ਹੈ ਕਿ ਪੰਜਾਬ ਵਿੱਚ ਨੌਕਰੀ ਕਰਨ ਲਈ ਪੰਜਾਬੀ ਪੜ੍ਹਨਾ ਬਹੁਤ ਜ਼ਰੂਰੀ ਹੈ ਜਿਹੜੀ ਪੰਜਾਬੀ ਭਾਸ਼ਾ ਹੈ ਬਹੁਤ ਰਿੱਚ ਭਾਸ਼ਾ ਬਹੁਤ ਵੱਡੀ ਹੈ ਇਸਦਾ ਜਿਹੜਾ ਦਾਇਰਾ ਬਹੁਤ ਵੱਡਾ ਹੈ ਵੱਡਾ ਹੈ ਇਹਨੂੰ ਸਿੱਖਣਾ ਬਹੁਤ ਔਖਾ ਹੈ ਓਕੇ ਥੈਂਕ ਯੂ